ਤੁਹਾਡੇ ਘਰ ਵਿੱਚ ਨਵੀਂ ਟੈਕਨੋਲੋਜੀ ਦੇ ਕਿਹੜੇ ਕਿਹੜੇ ਯੰਤਰ ਹਨ ਉਹਨਾਂ ਬਾਰੇ ਦੱਸੋ ਅਤੇ ਉਹਨਾਂ ਦਾ ਕੀ ਕੰਮ ਹੈ ਸਾਡੇ ਘਰ ਵਿੱਚ ਨਵੀਂ ਟੈਕਨੋਲੋਜੀ ਦਾ ਸਭ ਤੋਂ ਪਹਿਲਾਂ ਟੀ ਵੀ ਹੈ ਜੋ ਕਿ ਸਾਨੂੰ ਦੁਨੀਆ ਜਹਾਨ ਦੀਆਂ ਖ਼ਬਰਾਂ ਅਤੇ ਦੁਨੀਆ ਦੇ ਬਾਰੇ ਬਹੁਤ ਕੁਛ ਦੱਸਦਾ ਹੈ ਦੂਸਰਾ ਸਾਡੇ ਘਰ ਵਿੱਚ ਟੀ ਵੀ ਤੋਂ ਚੱਲਣ ਲਈ ਵਾਈਫਾਈ ਹੈ ਜੋ ਕਿ ਸਾਨੂੰ ਦੁਨੀਆ ਅਤੇ ਦੁਨੀਆ ਬਾਰੇ ਬਹੁਤ ਕੁਛ ਜਾਣਨ ਵਿੱਚ ਸਹਾਇਤਾ ਕਰਦਾ ਹੈ ਸਾਨੂੰ ਟੈਕਨੋਲੋਜੀ ਤੋਂ ਬਹੁਤ ਕੁਛ ਸਿੱਖਣ ਦੀ ਜ਼ਰੂਰਤ ਹੈ ਅਤੇ ਟੈਕਨੋਲੋਜੀ ਸਾਨੂੰ ਇਹਨਾਂ ਚੀਜ਼ਾਂ ਅਤੇ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ ਬਾਰੇ ਬਹੁਤ ਮਦਦ ਕਰ ਰਹੀ ਹੈ ਟੈਕਨੋਲੋਜੀ ਤੋਂ ਅਸੀਂ ਆਪਣੇ ਦੇਸ਼ ਅੰਤਰ ਦੇਸ਼ ਵਿਦੇਸ਼ ਬਾਰੇ ਜਾਣ ਸਕਦੇ ਹਾਂ ਅਤੇ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਨਾਲ ਬਿਨਾਂ ਕਿਸੇ ਰੁਕਾਵਟ ਤੋਂ ਗੱਲ ਬਾਤ ਕਰ ਸਕਦੇ ਹਾਂ ਅਤੇ ਬਹੁਤ ਦੁਨੀਆ ਜਹਾਨ ਦੀਆਂ ਗੱਲਾਂ ਬਾਰੇ ਜਾਣੂ ਹੋ ਸਕਦੇ ਹਾਂ ਸਾਨੂੰ ਇਸ ਟੈਕਨੋਲੋਜੀ ਨਾਲ ਵਿਚਰਨ ਅਤੇ ਇਸ ਦਾ ਫਾਇਦਾ ਉਠਾਉਣਾ ਆਉਣਾ ਚਾਹੀਦਾ ਹੈ